ਅੱਜ ਦੇ ਸਮੇਂ ਵਿੱਚ ਜਿਵੇਂ ਕਿ ਆਈ ਟੀ ਆਈ ਇਸ ਖੇਤਰ ਦੇ ਵਿੱਚ ਕਾਫ਼ੀ ਮੁਕਾਬਲੇ ਵੱਧ ਗਏ ਹਨ ਜੋ ਕਿ ਬਹੁਤ ਹੀ ਜ਼ਿਆਦਾ ਵਿਦਿਆਰਥੀ ਇਹਦੇ ਵਿੱਚ ਭਾਗ ਲੈਂਦੇ ਹਨ ਅਤੇ ਇਸ ਆਈ ਟੀ ਆਈ ਦੇ ਵਿੱਚ ਪੇਪਰ ਕਲੀਅਰ ਕਰਨਾ ਬਹੁਤ ਹੀ ਮੁਸ਼ਕਿਲ ਹੈ ਜੋ ਕਿ ਅੱਜ ਦੇ ਵਿਦਿਆਰਥੀਆਂ ਨੂੰ ਬਹੁਤ ਹੀ ਮੁਸ਼ਕਿਲ ਲੱਗਦਾ ਹੈ ਇਸ ਖੇਤਰ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਨਾ ਬਹੁਤ ਹੀ ਜ਼ਿਆਦਾ ਪੈਂਦਾ ਹੈ ਅਤੇ ਇਸਦੇ ਵਿੱਚ ਪ੍ਰਸੈਂਟੇਜਿਸ ਲੈਣਾ ਅਤੇ ਰੈਂਕ ਲੈਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੈ ਅਤੇ ਇਸ ਲਈ ਬਹੁਤ ਹੀ ਜ਼ਿਆਦਾ ਪੜ੍ਹਨਾ ਪੈਂਦਾ ਹੈ ਪਹਿਲਾਂ ਦੇ ਸਮੇਂ ਦੇ ਵਿੱਚ ਪ੍ਰਸੈਂਟੇਜਿਸ ਬਹੁਤ ਘੱਟ ਸੀਗੀਆਂ ਪਰ ਵੱਧਦੇ ਅੱਜ ਵੱਧਦੇ ਸਮਿਆਂ ਕਾਰਨ ਅੱਜ ਇਸ ਵਿੱਚ ਰੈਂਕ ਲੈਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਗਿਆ ਅਤੇ ਅਤੇ ਬਹੁਤ ਹੀ ਜ਼ਿਆਦਾ ਜਿਵੇਂ ਕਿ ਬਹੁਤ ਹੀ ਪੜ੍ਹਨਾ ਪੈਂਦਾ ਹੈ ਅਤੇ ਆਪਣਾ ਸਮਾਂ ਸਾਰਾ ਪੜ੍ਹਾਈ ਦੇ ਵਿੱਚ ਬਤੀਤ ਕਰਨਾ ਪੈਂਦਾ ਹੈ ਅਤੇ ਵਿਦਿਆਰਥੀਆਂ ਨੂੰ ਇਹ ਕਲੀਅਰ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਿਵੇਂ ਮੈਂ ਵੀ ਇੱਕ ਸਰਕਾਰੀ ਸਰਕਾਰੀ ਪੱਧਰ ਦੇ ਵਿੱਚ ਨੌਕਰੀ ਲੈਣ ਲਈ ਸ ਸਰਕਾਰੀ ਪੇਪਰ ਦਿੱਤਾ ਸੀ ਜੋ ਕਿ ਕਲੀਅਰ ਨਾ ਹੋ ਸਕਿਆ ਬਟ ਮੈਂ ਕੋਸ਼ਿਸ਼ ਕਰਾਂਗੀ ਕਿ ਇਹ ਮੇਰਾ ਅੱਗੇ ਫਿਊਚਰ ਦੇ ਵਿੱਚ ਹੋਪ ਸੋ ਕਲੀਅਰ ਹੋ ਜਾਵੇ ਅਤੇ ਮੈਂ ਵੀ ਇੱਕ ਨੌਕਰੀ ਲੈ ਸਕਾਂ